ਪੰਜਾਬੀ ਦੀ ਵਿਆਕਰਨ ਅਤੇ ਬਣਤਰ ਬਾਰੇ ਮੈਂ ਇੰਟਰਨੈੱਟ ਦੁਆਰਾ ਪੜ੍ਹਦੀ ਹਾਂ ਪਰੰਤੂ ਮੈਂ ਇਸ ਦਾ ਕੋਈ ਵੀ ਰਚਨਾਤਮਕ ਲਿੱਖਣ ਦਾ ਕੋਰਸ ਨਹੀਂ ਕੀਤਾ ਹੈ